ਅਜਿਹੇ ਬਹੁਤ ਤਰੀਕੇ ਹਨ ਜੋ ਕਿ ਦੌੜਨ ਦੇ ਨਾਲ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ ਅਤੇ ਜੇ ਗੱਲ ਕਰੀਏ ਕਿ ਦੌੜਨ ਤੋਂ ਬਾਅਦ ਆਰਾਮ ਮਿਲਦਾ ਹੈ ਤਾਂ ਹਾਂ ਮੈਨੂੰ ਬਹੁਤ ਆਰਾਮ ਮਿਲਦਾ ਹੈ ਇਸ ਨਾਲ ਮੇਰਾ ਸਰੀਰ ਫਿੱਟ ਰਹਿੰਦਾ ਅਤੇ ਇਸ ਲਈ ਮੈਂ ਰੋਜ਼ ਯੋਗਾ ਕਰਦੀ ਹਾਂ ਅਤੇ ਕਸਰਤ ਕਰਦੀ ਹਾਂ ਇਸ ਤੋਂ ਬਿਨਾਂ ਗੱਲ ਕਰੀਏ ਤਾਂ ਦੌੜਨ ਤੋਂ ਬਾਅਦ ਮਾਨਸਿਕ ਸਰੀਰ ਨੂੰ ਬਿਹਤਰ ਕਰਨ ਲਈ ਕਈ ਤਰੀਕੇ ਹੁੰਦੇ ਹਨ ਜਿਵੇਂ ਕਿ ਅੰਡਰਰੋਫਿਲ ਲੈਵਲ ਵਧਣਾ ਦੌੜਨ ਨਾਲ ਐਂਡਰੋਫਿਨ ਜੋ ਕਿ ਸੁੱਖ ਹਾਰਮੋਨ ਹਨ ਜੋ ਕਿ ਨਿਕਲਦੇ ਹਨ ਅਤੇ ਇਹ ਮਨੁੱਖ ਦੇ ਮਨ ਨੂੰ ਮੂਲ ਨੂੰ ਸੁਧਾਰਦੇ ਹਨ ਮਨ ਦੀ ਸ਼ਾਂਤੀ ਮਿਲਦੀ ਹੈ ਦੌੜਦੇ ਸਮੇਂ ਮਾਨਸਿਕ ਦਬਾਅ ਘੱਟਦਾ ਹੈ ਅਤੇ ਜਿਸ ਨਾਲ ਚਿੰਤਾ ਅਤੇ ਸਟਰੈਸ ਵਿੱਚ ਵੀ ਕਮੀ ਆਉਂਦੀ ਹੈ ਧਿਆਨ ਅਤੇ ਧਿਆਨ ਕੋਸ਼ ਮਤਲਬ ਦੌੜਨਾ ਇੱਕ ਧਿਆਨ ਕੋਸ਼ ਦਾ ਰੂਪ ਹੋ ਸਕਦਾ ਜਿਸ ਨਾਲ ਤੁਸੀਂ ਆਪਣੇ ਵਿਚਾਰਾਂ 'ਤੇ ਧਿਆਨ ਕੇਂਦਰਿਤ ਹੋ ਜਾਂਦੇ ਹੋ ਨਵੀਂ ਊਰਜਾ ਵੱਧ ਤੋਂ ਵੱਧ ਊਰਜਾ ਮਿਲਦੀ ਆ ਮਤਲਬ ਦੌੜਨ ਤੋਂ ਬਾਅਦ ਲੋਕ ਬਹੁਤ ਹਲਕੇ ਅਤੇ ਤੰਦਰੁਸਤ ਮਹਿਰੂਸ ਮਹਿਸੂਸ ਕਰਦੇ ਹਨ ਜਿਸ ਨਾਲ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਹੁੰਦਾ ਅਤੇ ਸਰੀਰ ਵੀ ਤਾਜ਼ਾ ਅਤੇ ਤੰਦਰੁਸਤ ਮਹਿਸੂਸ ਹੁੰਦਾ ਹੈ ਸਮਾਜਿਕ ਸੰਬੰਧ ਦੌੜਨ ਦੇ ਦਨ ਦੌਰਾਨ ਸਮਾਜਿਕ ਦੌੜਾਂ ਜਾਂ ਕੁਝ ਲੋਕਾਂ ਨਾਲ ਮਿਲ ਕੇ ਦੌੜਨ ਨਾਲ ਸਮਾਜਿਕ ਸੰਬੰਧ ਵੀ ਮਜਬੂਤ ਹੁੰਦੇ ਹਨ ਅਤੇ ਭਾਈਚਾਰੇ ਦੀ ਭਾਵਨਾ ਵੀ ਵੱਧਦੀ ਹੈ ਸਿਹਤਮੰਦ ਰੂਟੀਨ ਦੌੜਨ ਦੇ ਨਾਲ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਪੈਦਾ ਹੋਣ ਦੀ ਸੰਭਾਵਨਾ ਵੱਧਦੀ ਹੈ ਜੋ ਹਰ ਸਿਹਤਮੰਦ ਆਦਤਾਂ ਨੂੰ ਪ੍ਰਮੋਟ ਕਰਦੀ ਹੈ ਜਾਂ ਪ੍ਰੋਤਸਾਹਿਤ ਕਰਦੀ ਹੈ ਸਭ ਦੌੜਨ ਤੋਂ ਬਾਅਦ ਅਰਾਮ ਅਤੇ ਤੰਦਰੁਸਤੀ ਮਹਿਸੂਸ ਕਰਨਾ ਆਮ ਹੈ ਕਿਉਂਕਿ ਇਹ ਮਨ ਅਤੇ ਸਰੀਰ ਦੋਹਾਂ ਲਈ ਲਾਭਦਾਇਕ ਹੁੰਦਾ ਹੈ ਦੌੜਨ ਦੇ ਬਹੁਤ ਸਾਰੇ ਲਾਭ ਹੋਰ ਵੀ ਹਨ ਜੋ ਸਰੀਰਕ ਤੌਰ ਅਤੇ ਮਾਨਸਿਕ ਸਿਹਤ ਦੋਵਾਂ 'ਤੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ ਜਿਵੇਂ ਕਿ ਸਰੀਰਕ ਫਾਇਦੇ ਦੀ ਗੱਲ ਕਰੀਏ ਤਾਂ ਭਾਰੀ ਭਰਮਿਕਤਾ ਨੂੰ ਘਟਾਉਣਾ ਦੌੜਨ ਦੇ ਨਾਲ ਕੈਲਰੀ ਜ਼ਿਆਦਾ ਵਿਆਪਕ ਹੁੰਦੀ ਹੈ ਜੋ ਕਿ ਵਜ਼ਨ ਘਟਾਉਣ ਵਿੱਚ ਮਦਦ ਕਰਦੀ ਹੈ ਮਾਸਪੇਸ਼ੀਆਂ ਦੀ ਤਾਕਤ ਇਹ ਪੈਰਾਂ ਅਤੇ ਪੇਟਾਂ ਅਤੇ ਪਿੱਠ ਦੀ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀ ਹੈ ਕਾਰਬੋਵਲੈਕਸਰ ਕੂਲਰ ਸਿਹਤ ਦੌੜਨ ਦੇ ਨਾਲ ਹਿਰਦੇ ਦੀ ਸਿਹਤ ਸੁਧਰਦੀ ਹੈ ਰਕਤ ਚਾਪ ਨੂੰ ਕਾਬੂ ਵਿੱਚ ਰੱਖਦੀ ਹੈ ਅਤੇ ਚੱਕਰ ਚਾਲਕਤਾ ਨੂੰ ਵਧਾਉਂਦੀ ਹੈ ਮਾਨਸਿਕ ਫਾਇਦੇ ਕੀ ਹੁੰਦੇ ਨੇ ਮੂਡ ਵਿੱਚ ਸੁਧਾਰ ਹੋ ਜਾਂਦਾ ਮੂਡ ਸਹੀ ਹੋ ਜਾਂਦਾ ਦੌੜਨ ਦੇ ਨਾਲ ਐਂਟਰੋਫੈਂਸ ਦੀ ਜੋ ਮੂਡ ਨੂੰ ਬਿਹਤਰ ਕਰਨ ਵਿੱਚ ਹੋਰ ਵੀ ਜ਼ਿਆਦਾ ਸਹਾਇਕ ਹੁੰਦੀ ਹੈ ਚਿੰਤਾ ਅਤੇ ਡਿਪਰੈਸ਼ਨ ਘੱਟ ਜਾਂਦਾ ਹੈ ਦੌੜਨ ਦੇ ਨਾਲ ਚਿੰਤਾ ਦੇ ਲੱਛਣ ਨੂੰ ਘਟਾਉਣਾ ਅਤੇ ਮਾਨਸਿਕ ਤਣਾਅ ਵਿੱਚ ਕਮੀ ਵੀ ਆਉਂਦੀ ਹੈ ਸਿਹਤਮੰਦ ਜੀਵਨ ਸ਼ੈਲੀ ਬਣ ਜਾਂਦੀ ਹੈ ਸਿਹਤਮੰਦ ਆਦਤਾਂ ਰੱਖਣੀਆਂ ਚਾਹੀਦੀਆਂ ਹਨ ਜਿਵੇਂ ਕਿ ਦੌੜਾਂ ਦੇ ਨਾਲ ਤੁਸੀਂ ਹੋਰ ਸਿਹਤਮੰਦ ਆਦਤਾਂ ਦੀ ਤਰਫ ਵੀ ਪ੍ਰੇਰਿਤ ਹੋ ਜਾਂਦੇ ਜਿਵੇਂ ਕਿ ਸਿਹਤਮੰਦ ਖੁਰਾਕ ਅਤੇ ਅ ਖ ਖੁਰਾਕ ਲੈਣਾ ਨਿਸ਼ਾਨੇ ਦੀ ਪ੍ਰਾਪਤੀ ਦੌੜਨ ਦੇ ਟੀਚੇ ਬਣਾਉਣ ਨਾਲ ਆਪ ਲਗਨ ਅਤੇ ਆਤਮ ਵਿਸ਼ਵਾਸ ਵੀ ਵੱਧਦਾ ਸਮਾਜਿਕ ਲਾਭ ਦੇਖੀਏ ਤਾਂ ਸਮੂਹਿਕ ਦੌੜਾਂ ਵਿੱਚ ਦੋਸਤਾਂ ਜਾਂ ਸਮੂਹਾਂ ਨਾਲ ਦੌੜਨ ਨਾਲ ਸਮਾਜਿਕ ਬਨ ਵੀ ਮਜ਼ਬੂਤ ਹੁੰਦੇ ਹਨ ਸੰਗਠਨ ਤਕਤਾ ਸਮਾਂ ਪ੍ਰਬੰਧਨ ਮਤਲਬ ਦੌੜਨ ਦੇ ਨਾਲ ਤੁਸੀਂ ਆਪਣੇ ਸਮੇਂ ਨੂੰ ਬਿਹਤਰ ਢੰਗ ਨਾਲ ਪ੍ਰਬੰਧਿਤ ਕਰ ਸਕਦੇ ਹੋ ਜੋ ਇੱਕ ਮਨੋਵਿਗਿਆਨ ਤਣਾਓ ਨੂੰ ਵੀ ਘ ਘਟਾਉਂਦਾ ਹੈ ਨਿਯਮਿਤ ਦੌੜਨ ਦੇ ਲਾਭ ਕੀ ਹੁੰਦੇ ਨੇ ਉਮਰ ਦਾ ਪ੍ਰਭਾਵ ਨਿਯਮਿਤ ਦੌੜਨ ਦੇ ਨਾਲ ਉਮਰ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਜਿਸ ਨਾਲ ਸਿਹਤ ਬਿਹਤਰ ਮਹਿਸੂਸ ਹੁੰਦਾ ਇਸ ਤਰ੍ਹਾਂ ਦੌੜਨ ਦੇ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਉੱਤੇ ਗਹਿਰਾ ਪ੍ਰਭਾਵ ਪੈਂਦਾ ਜੋ ਸਮੂਹਿਕ ਤੌਰ 'ਤੇ ਸਿਹਤਮੰਦ ਜੀਵਨ ਸ਼ੈਲੀ ਵੀ ਪੈਦਾ ਕਰਦੀ ਹੈ